ਸਭ ਤੋਂ ਵੱਧ ਪ੍ਰੇਰਣਾਦਾਇਕ ਘਟਨਾ ਜਾਂ ਸ਼ਖਸ਼ੀਅਤ ਜੇ ਆਪਾਂ ਕਹੀਏ ਤਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਇਹਨਾਂ ਦੀ ਜਿਹੜੀ ਸ਼ਹੀਦੀ ਹੈ ਉਹ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੇਰਣਾਦਾਇਕ ਘਟਨਾ ਹੈ ਕਿ ਇੰਨੇ ਛੋਟੀ ਉਮਰਾਂ ਦੇ ਵਿੱਚ ਇੰਨੇ ਵੱਡੇ ਇਰਾਦੇ ਰੱਖਣੇ ਔਰ ਇੰਨੇ ਪੱਕੇ ਇਰਾਦੇ ਰੱਖਣੇ ਇਹ ਕੋਈ ਆਮ ਗੱਲ ਨਹੀਂ ਹੈ ਇਹ ਰੱਬ ਵੱਲੋਂ ਹੀ ਕੋਈ ਮਤਲਬ ਬਖਸ਼ਿਸ਼ ਸੀਗੀ ਜਿਹੜੇ ਉਹ ਇੰਨੀ ਛੋਟੀ ਉਮਰਾਂ ਦੇ ਵਿੱਚ ਉਹਨਾਂ ਨੇ ਇੰਨੇ ਵੱਡੇ ਜਿਹੜੇ ਉਹਨਾਂ ਦੇ ਇਰਾਦੇ ਸੀਗੇ ਅਤੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਉਹਨਾਂ ਨੇ ਜੋ ਵੀ ਕੁਛ ਕੀਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਿੱਖ ਧਰਮ ਨੂੰ ਬਚਾਉਣ ਲਈ ਕੀਤਾ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਜ਼ਿਆਦਾ ਪ੍ਰੇਰਨਾਦਾਇਕ ਘਟਨਾ ਹੈ ਜਿਹੜੀ ਕਿ ਮੇਰੀ ਆਪਣੀ ਸ਼ਖਸ਼ੀਅਤ ਨੂੰ ਬਣਾਉਣ ਦੇ ਵਿੱਚ ਵੀ ਕੰਮ ਆਉਂਦੀ ਹੈ